ਹਾਂਜੀ ਸਰ ਜੀ ਕੇ ਇੰਟਰਪ੍ਰਾਈਜ਼ਸ ਤੋਂ ਮੈਂ ਨਾ ਤੁਹਾਡੇ ਤੋਂ ਸੈਮਸੰਗ ਦਾ ਫ਼ੋਨ ਲਿਆ ਸੀ ਬਹੁਤ ਵਧੀਆ ਨਿਕਲਿਆ ਤਾਂ ਕੈਮਰਾ ਵੀ ਬੜਾ ਸੋਹਣਾ ਚਲਦਾ ਇਹਦਾ ਅਤੇ ਵੈਸੇ ਵੀ ਬਹੁਤ ਜਲਦੀ ਪਿੱਕ ਅੱਪ ਇਹਦੀ ਕੋਈ ਵੀ ਮੈਂ ਚਲਾਉਂਦੀ ਹਾਂ ਪਲੇਸਟੋਰ ਤੋਂ ਐਪ 'ਤੇ ਬੜੀ ਛੇਤੀ ਚੱਲਦਾ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ